ਹਾਂਜੀ ਸਾਡੇ ਖੇਤਰ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਕਬਾਇਲੀ ਕਲਾਵਾਂ ਕਰਵਾਈਆਂ ਜਾਂਦੀਆਂ ਹਨ ਜਿਵੇਂ ਕਿ ਚਰਖਾ ਕੱਤਣਾ ਕਢਾਈ ਕਰਨਾ ਪੀੜ੍ਹੀ ਬੁਣਨਾ ਅਤੇ ਨਾਲੇ ਬੁਣਨਾ ਅਸੀਂ ਇੰਨਾਂ ਸੱਭਿਆਚਾਰਕ ਚੀਜ਼ਾਂ ਨਾਲ ਜੁੜੇ ਰਹਿ ਕੇ ਇਹਨਾਂ ਚੀਜ਼ਾਂ ਨੂੰ ਸੰਭਾਲ ਸਕਦੇ ਹਾਂ ਜਿਵੇਂ ਘਰ ਵਿੱਚ ਪਹਿਲਾਂ ਮੇਰੇ ਦਾਦੀ ਜੀ ਇਹ ਸਭ ਕੁਝ ਬੁਣਦੇ ਸਨ ਅਤੇ ਫਿਰ ਮੇਰੀ ਮੰਮੀ ਨੇ ਉਹਨਾਂ ਤੋਂ ਨਾਲੇ ਬੁਣਨਾ ਚਰਖਾ ਕੱਤਣਾ ਪੀੜ੍ਹੀ ਬੁਣਨੀ ਸ ਸਿੱਖੀ ਕਿਉਂਕਿ ਕਢਾਈ ਕਰਨਾ ਉਹਨਾਂ ਨੂੰ ਪਹਿਲਾਂ ਤੋਂ ਹੀ ਆਉਂਦਾ ਸੀ ਪਰ ਅੱਜ ਕੱਲ੍ਹ ਦੀ ਜੋ ਜਨਰੇਸ਼ਨ ਹੈ ਉਹ ਵੈਸਟਰਨ ਕਲਚਰ ਵੱਲ ਜਾ ਰਹੀ ਹੈ ਅਤੇ ਆਪਣਾ ਸੱਭਿਆਚਾਰ ਉਹ ਭੁੱਲਦੇ ਜਾ ਰਹੇ ਹਨ ਸਾਨੂੰ ਇਸ ਨੂੰ ਬਚਾਉਣ ਲਈ ਆਪਣੇ ਖੇਤਰ ਵਿੱਚ ਇਹ ਸਾਰੀਆਂ ਕਲਾਵਾਂ ਕਰਵਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਕ ਇੱਕ ਘਰ ਵਿੱਚ ਇਸਤਰੀਆਂ ਹੁੰਦੀਆਂ ਹਨ ਉਹ ਆਪਣੇ ਖੇਤਰ ਵਿੱਚ ਦਸ ਤੋਂ ਪੰਦਰ੍ਹਾਂ ਇਸਤਰੀਆਂ ਇਕੱਠੀਆਂ ਹੋ ਕੇ ਨਾਲੇ ਬੁਣਨ ਚਰਖੇ ਕੱਤਣ ਜਾਂ ਫਿਰ ਕਢਾਈ ਕਰਨ ਤਾਂ ਕਿ ਉਹਨਾਂ ਦੇ ਅੱਗੇ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਤਾ ਲੱਗ ਜਾਵੇ ਜਿਵੇਂ ਸਕੂਲਾਂ ਕਾਲਜਾਂ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਉਹ ਸਾਨੂੰ ਸਾਡੇ ਸੱਭਿਆਚਾਰ ਬਾਰੇ ਦੱਸਦੇ ਹਨ